ਵੈਸੇ ਤਾਂ ਮੈਨੂੰ ਤੈਰਾਕੀ ਦਾ ਕੋਈ ਤਜ਼ਰਬਾ ਜਿਹੜਾ ਉਹ ਨਹੀਂ ਹੈਗਾ ਪਰ ਮੈਂ ਜਿਹੜਾ ਫਿਲਮਾਂ ਦੇ ਵਿੱਚ ਦੇਖਿਆ ਹੈ ਕਿ ਜਦੋਂ ਕੋਈ ਵਿਅਕਤੀ ਤੈਰਦਾ ਹੋਇਆ ਡੁੱਬਣ ਲੱਗਦਾ ਹੈ ਤਾਂ ਉਹਨੂੰ ਕਿਵੇਂ ਬਚਾਇਆ ਜਾਂਦਾ ਹੈ ਜਿਹੜਾ ਬਚਾਉਣ ਵਾਲਾ ਬੰਦਾ ਹੁੰਦਾ ਹੈ ਉਹ ਖੁਦ ਤੈਰਾਕ ਹੁੰਦਾ ਮਤਲਬ ਉਹਨੂੰ ਤੈਰਨਾ ਆਉਂਦਾ ਹੈ ਤਾਂ ਉਹਨੂੰ ਇਸ ਡੁੱਬਣ ਵਾਲੀ ਸਥਿਤੀ ਦੇ ਵਿੱਚੋਂ ਉਹ ਕੱਢ ਲੈਂਦਾ ਹੈ ਇਸ ਤਰ੍ਹਾਂ ਮੈਂ ਇਹ ਉਹਦੇ ਵਿੱਚੋਂ ਸਿੱਖਿਆ ਕਿ ਜੇ ਤੁਹਾਨੂੰ ਖੁਦ ਨੂੰ ਤੈਰਾਕੀ ਕਰਨੀ ਆਉਂਦੀ ਆ ਤਾਂ ਤੁਸੀਂ ਦੂਜੇ ਦੀ ਬੰਦੇ ਦੀ ਮਦਦ ਕਰ ਸਕਦੇ ਹੋ ਤੈਰਨ ਦੇ ਵਿੱਚ ਜਾਂ ਉਹਦੇ ਖਤਰੇ ਨੂੰ ਟਾਲਣ ਦੇ ਵਿੱਚ ਇਸ ਲਈ ਮੈਨੂੰ ਭਵਿੱਖ ਦੇ ਵਿੱਚ ਜੇਕਰ ਕਦੇ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਜਿਹੜੀ ਤੈਰਾਕੀ ਸਿਖੂੰਗੀ